ਭਾਰਤੀ ਸਿੱਖਿਆ ਪ੍ਰਣਾਲੀ ਸੌਖੀ ਹੈ ਬਟ ਇਹਦੇ ਵਿੱਚ ਕਈ ਚੁਣੌਤੀਆਂ ਵੀ ਆਉਂਦੀਆਂ ਹਨ ਜਿਵੇਂ ਪਿੰਡਾਂ ਵਿੱਚ ਕਈ ਵਿਦਿਆਰਥੀ ਹਨ ਜਿਹਨਾਂ ਨੂੰ ਸ਼ਹਿਰਾਂ ਵਿੱਚ ਕੋਲਜ ਵਿੱਚ ਪੜ੍ਹਨ ਆਉਣਾ ਪੈਂ ਆਉਣ ਲਈ ਬੜੀ ਮੁਸ਼ਕਿਲ ਹੁੰਦਾ ਅਤੇ ਸਵੇਰੇ ਸਵੇਰੇ ਉੱਠ ਕੇ ਬੱਸਾਂ ਵਿੱਚ ਆਉਂਦੇ ਹਨ ਅਤੇ ਜਿਸ ਕਾਰਨ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਹੁੰਦੀ ਹੈ ਅਤੇ ਕਾਲਜਾਂ ਜਾਂ ਸਕੂਲਾਂ ਵਿੱਚ ਫੀਸਾਂ ਬਹੁਤ ਹੀ ਜ਼ਿਆਦਾ ਹੋਣ ਕਾਰਨ ਵੀ ਕਈ ਵਿਦਿਆਰਥੀ ਨਹੀਂ ਪੜ੍ਹ ਪਾਉਂਦੇ ਹਨ ਅਤੇ ਪਿੰਡਾਂ ਵਗੈਰਾ ਵਿੱਚ ਜਿੰਨੇ ਵੀ ਅਧਿਆਪਕ ਹਨ ਉਹ ਘੱਟ ਹਨ ਅਤੇ ਬਹੁਤ ਹੀ ਨੂੰ ਇੱਕ ਵਾਰ 'ਚ ਪੜ੍ਹਾਉਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਅਧਿ ਅਧਿਆਪਿਕਾਵਾਂ ਜਿਹੜੇ ਹਨ ਉਹ ਵਿਦਿਆਰਥੀਆਂ ਨੂੰ ਸਿੱਖਿਆ ਜੋ ਦਿੰਦੇ ਹਨ ਉਹਨਾਂ ਵਿੱਚ ਵੀ ਮੁਸ਼ਕਿਲ ਆਉਂਦੀ ਹੈ ਅਤੇ ਸ ਸਰਕਾਰ ਇਹਨਾਂ ਸਿੱਖਿਆ ਪ੍ਰਣਾਲੀ 'ਤੇ ਕਈ ਕੰਮ ਕਰ ਰਹੀ ਹੈ ਜੋ ਕਿ ਬਹੁਤ ਹੀ ਵਧੀਆ ਗੱਲ ਹੈ